ਪ੍ਰਧਾਨ ਮੰਤਰੀ ਆਵਾਸ ਯੋਜਨਾ ਮੈਂ ਖੁਦ ਵੀ ਲੈ ਰਿਹਾ ਹਾਂ ਮੈਂ ਜਦੋਂ ਹੋਮ ਲੋਨ ਘਰ 'ਤੇ ਘਰ ਬਣਾਉਣ ਲਈ ਲੋਨ ਲਿਆ ਸੀ ਉਸ ਵਿੱਚ ਮੈਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਕੁਛ ਪਰਸੈਂਟ ਸਬਸਿਡੀ ਵੀ ਮਿਲੀ ਹੈ ਅਤੇ ਇਹ ਸਕੀਮ ਦੋ ਹਜ਼ਾਰ ਪੰਦਰ੍ਹਾਂ ਤੋਂ ਸਰ ਸੈਂਟਰ ਸਰਕਾਰ ਵੱਲੋਂ ਚਲਾਈ ਗਈ ਸੀ ਜਿਸਦਾ ਮੈਂ ਜ ਬਹੁਤ ਲਾਭ ਉਠਾ ਚੁੱਕਿਆ ਹਾਂ